ਇੱਕ ਸੌ ਪੰਝੱਤਰ ਇੱਕ ਹਜ਼ਾਰ ਨੌ ਸੌ ਚੌਂਤੀ ਪੰਜ ਹਜ਼ਾਰ ਅੱਠ ਸੌ ਪੈਂਹਠ ਪੈਂਹਠ ਹਜ਼ਾਰ ਨੌ ਸੌ ਉਣਤਾਲੀ ਨੌ ਲੱਖ ਪੰਦਰ੍ਹਾਂ ਹਜ਼ਾਰ ਚਾਰ ਸੌ ਛੱਤੀ